ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਮੁੱਖ ਸੱਭਿਆਚਾਰਕ ਅਤੇ ਸਮਾਜਿਕ ਪਰੰਪਰਾਵਾਂ ਹਨ ਜਿਹਨਾਂ ਨੂੰ ਇੱਥੇ ਰਹਿਣ ਵਾਲੇ ਲੋਕ ਬਹੁਤ ਹੀ ਬਾਖੂਬੀ ਨਾਲ ਨਿਭਾਉਂਦੇ ਹਨ ਇੱਥੇ ਦੇ ਸੱਭਿਆਚਾਰਕ ਪਰੰਪਰਾਵਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਸੱਭਿਆਚਾਰ ਜਿਵੇਂ ਕਿ ਸੱਭਿਆਚਾਰ ਨੂੰ ਦਰਸਾਉਣ ਲਈ ਲੋਕ ਆਪਣੀ ਸੱਭਿਆਚਾਰਤਾ ਨੂੰ ਪੇਸ਼ ਕਰਦੇ ਹਨ ਜਿਵੇਂ ਕਿ ਪੰਜਾਬੀ ਆਪਣੀ ਸੱਭਿਆਚਾਰਕਤਾ ਨੂੰ ਪ ਪੇਸ਼ ਕਰਨ ਲਈ ਭੰਗੜਾ ਗਿੱਧਾ ਜਾਂ ਹੋਰ ਕੋਈ ਸੱਭਿਆਚਾਰਕ ਪੇਸ਼ ਕਰੇ ਸੱਭਿਆਚਾਰ ਪੇਸ਼ ਕਰਨ ਲਈ ਹੋਰ ਕੋਈ ਐਕਟੀਵਿਟੀ ਕਰੇਗਾ ਇਸ ਤਰ੍ਹਾਂ ਸਮਾਜਿਕ ਪਰੰਪਰਾਵਾਂ ਨੂੰ ਉਹ ਆਪਣੇ ਰੀਤੀ ਰਿਵਾਜ਼ ਦਰਸਾਵੇਗਾ ਅਤੇ ਉਹ ਆਪਣੀ ਭਾਸ਼ਾ ਨੂੰ ਅਤੇ ਆਪਣੇ ਧਰਮ ਨੂੰ ਦਰਸਾਵੇਗਾ ਇੱਥੇ ਲੋਕ ਵੱਖ ਵੱਖ ਧਾਰਮਿਕ ਅਭਿਆਸ ਵਿੱਚ ਸ਼ਾਮਿਲ ਹੁੰਦੇ ਹਨ ਅਗਰ ਇੱਥੇ ਕੋਈ ਵਿਦੇਸ਼ ਅ ਵਿਦੇਸ਼ੀ ਇੱਥੇ ਆਉਂਦਾ ਹੈ ਤਾਂ ਇੱਥੇ ਦੇ ਜਿਹੜੇ ਲੋਕ ਹਨ ਉਹ ਆਪਣੀ ਵਿਦੇਸ਼ੀ ਪਰੰਪਰਾ ਨੂੰ ਅਤੇ ਸੱਭਿਆਚਾਰਕ ਦਾ ਵਰਣਨ ਕਰਨ ਲਈ ਉਸਨੂੰ ਕਿਸੇ ਮੰਦਿਰ ਵਿੱਚ ਲੇਕਰ ਜਾਵੇਗਾ ਜਾਂ ਉਸਨੂੰ ਆਪਣਾ ਪੰਜਾਬ ਦਾ ਜਾਂ ਆਪਣੇ ਸ਼ਹੀਦ ਭਗਤ ਸਿੰਘ ਨਗਰ ਦਾ ਜੋ ਵੀ ਮਸ਼ਹੂਰ ਖਾਣਾ ਹੈ ਉਹ ਉਸਨੂੰ ਖਿਲਾਵੇਗਾ ਜਾਂ ਉਹ ਜੋ ਵੀ ਇਨਸਾਨ ਉਸ ਵਿਦੇਸ਼ੀ ਆਦਮੀ ਨਾਲ ਮਿਲਵਰਤਨ ਕਰੇਗਾ ਤਾਂ ਉਹ ਆਪਣੇ ਹਿਸਾਬ ਨਾਲ ਆਪਣਾ ਸੱਭਿਆਚਾਰ ਜਿਸ ਸੱਭਿਆਚਾਰ ਨੂੰ ਉਹ ਫੋਲ ਮੰਨਦਾ ਹੈ ਉਹ ਆਪਣੇ ਹਿਸਾਬ ਨਾਲ ਉਸ ਸੱਭਿਆਚਾਰ ਨੂੰ ਦਰਸਾਵੇਗਾ ਜਿਵੇਂ ਕਿ ਕੋਈ ਪੰਜਾਬੀ ਅਗਰ ਜਾਂ ਕੋਈ ਸਿੱਖ ਮਿਲਦਾ ਹੈ ਤਾਂ ਉਹ ਆਪਣੇ ਸੱਭਿਆਚਾਰਤਾ ਨੂੰ ਦਰਸਾਉਣ ਲਈ ਕਿਸੇ ਵਿਦੇਸ਼ੀ ਨੂੰ ਮੱਕੀ ਦੀ ਰੋਟੀ ਸਾਗ ਲੱਸੀ ਇਸ ਤਰ੍ਹਾਂ ਦੇ ਭੋਜਨ ਖਵਾ ਕੇ ਉਹ ਆਪਣੀ ਸੱਭਿਆਚਾਰਤਾ ਨੂੰ ਪੇਸ਼ ਕਰਦਾ ਹੈ ਜਾਂ ਉਹ ਉਸਨੂੰ ਗੁਰਦੁਆਰੇ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਹਰੇਕ ਧਰਮ ਦੇ ਲੋਕ ਅਲੱਗ ਅਲੱਗ ਤਰ੍ਹਾਂ ਦੀਆਂ ਸੱਭਿਆਚਾਰਤਾ ਔਰ ਆਪਣੀ ਪਰੰਪਰਾ ਨੂੰ ਪੇਸ਼ ਕਰਦੇ ਹਨ ਮੇਨ ਪਰੰਪਰਾ ਜੋ ਇਸ ਜੋ ਮੇਨ ਸੱਭਿਆਚਾਰਤਾ ਦਰਸਾਈ ਜਾਂਦੀ ਹੈ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਉਹ ਇਹ ਹੈ ਕਿ ਪੰਜਾਬੀ ਆਪਣੀ ਪੰਜਾਬੀਅਤ ਨੂੰ ਦਿਖਾਉਂਦਾ ਹੈ ਮਤਲਬ ਕਿ ਆਪਣੇ ਪੰਜਾਬ ਦੇ ਮਸ਼ਹੂਰ ਖਾਣਾ ਜਿਵੇਂ ਸਾਗ ਮੱਕੀ ਦੀ ਰੋਟੀ ਆਦਿ ਨਾਲ ਆਪਣੇ ਸੱਭਿਆਚਾਰ ਨੂੰ ਦਰਸਾਉਂਦਾ ਹੈ